ਉੱਨੀ ਸੌ ਪੈਂਹਠ ਵਿੱਚ ਇੰਡੀਆ ਅਤੇ ਪਾਕਿਸਤਾਨ ਦੀ ਲੜਾਈ ਹੋਈ ਸੀ ਪਾਕਿਸਤਾਨ ਦੇ ਲੜਾਕੂ ਜਹਾਜ਼ ਅੰਮ੍ਰਿਤਸਰ ਅਤੇ ਉਸਦੇ ਆਸ ਪਾਸ ਦੇ ਹੋਰ ਕਈ ਇਲਾਕਿਆਂ ਉੱਪਰ ਘੁੰਮ ਰਹੇ ਸਨ ਅਤੇ ਉਹ ਜਿਸ ਘਰ ਵਿੱਚ ਵੀ ਰੋਸ਼ਨੀ ਦੇਖ ਲੈਂਦੇ ਸਨ ਜਾਂ ਜਿ ਉਹਨਾਂ ਨੂੰ ਲੱਗਦਾ ਸੀ ਕਿ ਇੱਥੇ ਲੋਕ ਹਨ ਤਾਂ ਉਹ ਉੱਥੇ ਬੰਬ ਸੁੱਟ ਦਿੰਦੇ ਸਨ ਇਹ ਦੇਖਦੇ ਹੋਏ ਇੰਡੀਆ ਦੀ ਸਰਕਾਰ ਨੇ ਬਲੈਕ ਆਊਟ ਦਾ ਐਲਾਨ ਕੀਤਾ ਜਿਸ ਵਿੱਚ ਕੋਈ ਵੀ ਰਾਤ ਦੇ ਵੇਲੇ ਆਪਣੇ ਘਰ ਵਿੱਚ ਰੋਸ਼ਨੀ ਨਹੀਂ ਜਗਾਏਗਾ ਇਸ ਤਰ੍ਹਾਂ ਅਸੀਂ ਉਹਨਾਂ ਤੋਂ ਬਚ ਸਕਦੇ ਹਾਂ ਅਤੇ ਇਹ ਲੜਾਈ ਕਾਫ਼ੀ ਟਾਈਮ ਤੱਕ ਜਾਰੀ ਰਹੀ ਪਰ ਪਾਕਿਸਤਾਨ ਇੰਡੀਆ ਤੋਂ ਜਿੱਤ ਨਾ ਸਕਿਆ ਇਹ ਘਟਨਾ ਮੈਨੂੰ ਮੇਰੇ ਦਾਦਾ ਜੀ ਨੇ ਸੁਣਾਈ ਸੀ ਅਤੇ ਇਸ ਤੋਂ ਬਾਅਦ ਉੱਨੀ ਸੌ ਚੁਰਾਸੀ ਵਿੱਚ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਪਰ ਹਮਲਾ ਕਰਵਾਇਆ ਸੀ ਮੇਰਾ ਘਰ ਦਰਬਾਰ ਸਾਹਿਬ ਦੇ ਲਾਗੇ ਹੈ ਅਤੇ ਇਹ ਘਟਨਾ ਮੈਨੂੰ ਮੇਰੇ ਪਾਪਾ ਨੇ ਸੁਣਾਈ ਸੀ ਕਿ ਜਦੋਂ ਦਰਬਾਰ ਸਾਹਿਬ ਉੱਤੇ ਤੋਪ ਦੇ ਗੋਲੇ ਸੁੱਟੇ ਜਾਂਦੇ ਸੀ ਤਾਂ ਸਾਡੇ ਘਰਾਂ ਦੀਆਂ ਖਿੜਕੀਆਂ ਅਤੇ ਕੰਧਾਂ ਕੰਬਦੀਆਂ ਸਨ ਅਤੇ ਉਹਨਾਂ ਤੋਂ ਬਚਣ ਲਈ ਸਾਰੇ ਆਪਣੇ ਲਾ ਇਲਾਕੇ ਦੇ ਗੁਰਦੁਆਰੇ ਵਿੱਚ ਇਕੱਠੇ ਹੋ ਜਾਂਦੇ ਸਨ ਅਤੇ ਰਾਤ ਵੀ ਉਹ ਉੱਥੇ ਹੀ ਰਹਿੰਦੇ ਸਨ ਕਿ ਕਿਤੇ ਕੋਈ ਅਣਹੋਣੀ ਨਾ ਹੋ ਜਾਵੇ